ਮੈਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਵੈਸੇ ਤਾਂ ਮੈਂ ਬਚਪਨ ਤੋਂ ਹੀ ਡਾਂਸ ਕਰ ਰਹੀ ਹਾਂ ਹਰ ਛੋਟੇ ਛੋਟੇ ਫੰਕਸ਼ਨ ਐਕਟੀਵਿਟੀਜ਼ ਦੇ ਵਿੱਚ ਮੈਂ ਹਿੱਸਾ ਲਿਆ ਅਤੇ ਮੈਂ ਅੱਵਲ ਵੀ ਰਹੀ ਹਾਂ ਪਰ ਹੁਣ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਮੈਂ ਜੋਬ ਕਰਦੀ ਹਾਂ ਅਤੇ ਮੈਂ ਆਪਣਾ ਉਹ ਟਾਈਮ ਸਮਾਂ ਆਪਣੇ ਆਪ ਨੂੰ ਨਹੀਂ ਦੇ ਪਾਉਂਦੀ ਪਰ ਫਿਰ ਵੀ ਜਦ ਵੀ ਮੈਨੂੰ ਥੋੜ੍ਹਾ ਸਮਾਂ ਮਿਲਦਾ ਹੈ ਮੈਂ ਯੂਟਿਊਬ ਰਾਹੀਂ ਜਾਂ ਮਿਊਜ਼ਿਕ ਸਿਸਟਮ ਰਾਹੀਂ ਗਾਣੇ ਸੁਣ ਕੇ ਅਪ ਆਪਣੇ ਡਾਂਸ ਦੀ ਪ੍ਰੈਕਟਿਸ ਕਰਦੀ ਰਹਿੰਦੀ ਹਾਂ ਔਰ ਕਿਸੇ ਵੀ ਫੰਕਸ਼ਨਸ ਵਗੈਰਾ ਦੇ ਵਿੱਚ ਮੈਨੂੰ ਨ ਡਾਂਸ ਕਰਨਾ ਅੱਛਾ ਲੱਗਦਾ ਹੈ ਅਗਰ ਜੇ ਮੈਨੂੰ ਮੌਕਾ ਮਿਲਿਆ ਜਾਵੇ ਕਿ ਮੈਨੂੰ ਕਿਤੇ ਪਯੋ ਪ੍ਰਤੀਯੋਗਤਾ ਵਿੱਚ ਹੇ ਹਿੱਸਾ ਲੈਣ ਦਾ ਤਾਂ ਮੈਂ ਜ਼ਰੂਰ ਲਉਂਗੀ ਔਰ ਮੈਂ ਇਸ ਚੀਜ਼ ਨੂੰ ਕ ਪਹਿਲ ਵੀ ਬੱਚਿਆਂ ਆਪਣੇ ਬੱਚਿਆਂ ਨੂੰ ਵੀ ਪਹਿਲ ਦੂੰਗੀ ਕਿ ਉਹ ਉਹ ਹਰ ਐਕਟੀਵਿਟੀ ਨੂੰ ਸਿੱਖਣ ਖਾਸ ਕਰਕੇ ਡਾਂਸ ਐਕਸੀ ਇੱਦਾਂ ਦੀ ਐਕਟੀਵਿਟੀ ਹੈ ਜਿਹਦੇ ਵਿੱਚ ਨੂੰ ਹਰ ਕਿਸੇ ਤਰ੍ਹਾਂ ਹਰ ਕੇਸਰ ਹਰ ਪ੍ਰਾਂਤ ਦੇ ਡਾਂਸ ਨੂੰ ਸਿੱਖਣਾ ਚਾਹੀਦਾ ਹੈ